ਹੈਲੋ ਹੋਰ ਵਧੀਆ ਮਨਪ੍ਰੀਤ ਤੂੰ ਦੱਸ ਕੀ ਹਾਲ ਨੇ ਤੇਰੇ ਹੋਰ ਘਰ ਪਰਿਵਾਰ ਸਾਰੇ ਵਧੀਆ ਹਾਂ ਠੀਕ ਠਾਕ ਹੋਰ ਬੜੇ ਦਿਨਾਂ ਬਾਅਦ ਯਾਦ ਕੀਤਾ ਅੱਛਾ ਹੋਰ ਕਣਕ ਵਗੈਰਾ ਵਧੀਆ ਹੋ ਗਈ ਚੰਗਾ ਝਾੜ ਦੇ ਗਈ ਚਲ ਵਧੀਆ ਹਾਂ ਆਪਣੇ ਵੀ ਬਾਈ ਪਚਵੰਜਾ ਤੋਂ ਸੱਠ ਦੇ ਵਿੱਚ ਵਿੱਚ ਝੜੀ ਹੈਗੀ ਅੱਛਾ ਝੋਨਾ ਨਹੀਂ ਲਾਇਆ ਐਂਤਕੀ ਅੱਛਾ ਹਾਂ ਪਨੀਰੀ ਲਾਈ ਜਾਂਦੇ ਆ ਆਪਣੀ ਵੀ ਪਿੰਡ 'ਚ ਹੁਣ ਪਨੀਰੀਆਂ ਬੀਜੀ ਜਾਂਦੇ ਆ ਲੋਕ ਜ਼ਿਆਦਾ ਤਾਂ ਹੁਣ ਦੋ ਸੌ ਬਾਰਾਂ ਲਾਈ ਜਾਂਦੇ ਹੈਗੇ ਦੋ ਸੌ ਬਾਰਾਂ ਦਾ ਹੁਣ ਪਨੀਰੀ ਦਾ ਟਾਈਮ ਹੀ ਹੈਗਾ ਦੋ ਸੌ ਬਾਰਾਂ ਝੋਨਾ ਪਰਮਲ ਝੋਨਾ ਆਪਣਾ ਵਧੀਆ ਹੋ ਜਾਂਦਾ ਹੈਗਾ ਅੱਸੀ ਪਚਾਸੀ ਮਣ ਹੈਗਾ ਝਾੜ ਇਹਦਾ ਪਾਣੀ ਦਰਮਿਆਨਾ ਜਿਹਾ ਚਲ ਜਾਂਦਾ ਬਾਹਲੇ ਚੰਗੇ ਦੀ ਲੋੜ ਨਹੀਂ ਇਹਨੂੰ ਇਹ ਦੇਖ ਲਓ ਤੁਹਾਡੇ ਬਾਨ ਤਾਂ ਚੰਗੇ ਹੀ ਆ ਵੈਸੇ ਪਾਣੀ ਤਾਂ ਤੁਹਾਡਾ ਇੱਕ ਨੰਬਰ ਹੀ ਕੱਸੀ ਦਾ ਪਾਣੀ ਕਿੰਨਾ ਕੁ ਆਉਂਦਾ ਆਪਣੇ ਕੱਸੀ ਦਾ ਪਾਣੀ ਵਧੀਆ ਲੱਗਦਾ ਹਾਂ ਫਿਰ ਤੁਸੀਂ ਪੂਸਾ ਇੱਕਤਾਲ਼ੀ ਜਾਂ ਮੁੱਛਲ ਇਹ ਵੀ ਆਪਣੇ ਵਧੀਆ ਹੋ ਜਾਂਦਾ ਫਿਰ ਤਾਂ ਇਹ ਵੀ ਦੇਖ ਲਓ ਇਹਨੂੰ ਪਾਣੀ ਇੱਕ ਨੰਬਰ ਚਾਹੀਦਾ ਅਤੇ ਸਪਰੇ ਵਗੈਰਾ ਇਹਨੂੰ ਥੋੜ੍ਹੀ ਜਿਹੀ ਐਂ ਆ ਧਿਆਨ ਨਾਲ ਕਰਨੀ ਪੈਂਦੀ ਹੈਗੀ ਹਾਂ ਝਾੜ ਇਹਦਾ ਵੀ ਬਹੁਤ ਚੰਗਾ ਇਹ ਮੰਨਲਾ ਹੋ ਜਾਂਦਾ ਕਿੱਲੇ ਚੋਂ ਲੱਖ ਸਵਾ ਲੱਖ ਦੇ ਲਗਭਗ ਹੋ ਜਾਂਦਾ ਹਾਂ ਜੇ ਕੋਈ ਮੰਨਲਾ ਮੱਕੀ ਮੁੱਕੀ ਦੀ ਮੱਕੀ ਮੁੱਕੀ ਦੀ ਸਲਾਹ ਹੈਗੀ ਆ ਤੇਰੀ ਵੀ ਪਹਿਲਾਂ ਆਪਾਂ ਮੱਕੀ ਬੀਜਣੀ ਹੈਗੀ ਅਚਾਰ ਪਾ ਕੇ ਫਿਰ ਝੋਨਾ ਲਗਾਉਣਾ ਤਾਂ ਫਿਰ ਉਹਦੇ ਹੱਥ ਦਾ ਇੱਕ ਸੌ ਛੱਬੀ ਝੋਨਾ ਲਾ ਲਓ ਹਾਂ ਕਿੱਲਾ ਦੋ ਕਿੱਲੇ ਆਚਾਰ ਪਾ ਕੇ ਨਾਲੇ ਪਸ਼ੂਆਂ ਨੂੰ ਆਚਾਰ ਦਾ ਵਧੀਆ ਹੋ ਜਾਂਦਾ ਹਾਂ ਪੈਨਰ ਦੀ ਮੱਕੀ ਬੀਜ ਲਿਓ ਪੈਨਰ ਦੀ ਮੱਕੀ ਵਧੀਆ ਹੁੰਦੀ ਹੈ ਅਤੇ ਉੱਦੋਂ ਬਾਅਦ ਇੱਕ ਸੌ ਛੱਬੀ ਲੱਗ ਜੂਗਾ ਇੱਕ ਸੌ ਛੱਬੀ ਪਛੇਤਾ ਝੋਨਾ ਸਾਰਾ ਨੱਬੇ ਕੁ ਦਿਨਾਂ 'ਚ ਆ ਜਾਂਦਾ ਹਾਂ ਮੱਕੀ ਤੋਂ ਬਾਅਦ ਬਹੁਤ ਵਧੀਆ ਅੱਸੀ ਮਣ ਝਾੜ ਇਹਦਾ ਵੀ ਹੋ ਜਾਂਦਾ ਹੈਗਾ ਕੱਦ ਵੀ ਇਹਦਾ ਛੋਟਾ ਰਹਿੰਦਾ ਇਹਨੂੰ ਬਿਮਾਰੀ ਵੀ ਘੱਟ ਪੈਂਦੀ ਆ ਪਾਣੀ ਦੀ ਵੀ ਲੋੜ ਘੱਟ ਰਹਿੰਦੀ ਹੈ

ਹਾਂ ਦੋ ਕੁ ਕਿੱਲੇ ਮੱਕੀ ਲਾ ਲਿਓ ਬਾਕੀ ਜੇ ਤੇਰਾ ਇਰਾਦਾ ਹੈਗਾ ਬਾਸਮਤੀ ਝੋਨਾ ਲਾਉਣ ਦਾ ਬਾਸਮਤੀ ਝੋਨਾ ਵੀ ਦੇਖ ਲਓ ਗਿਆਰਾਂ ਇੱਕੀ ਅਠਾਰਾਂ ਸੰਤਾਲੀ ਇਹਨਾਂ 'ਚ ਦੇਖ ਲਾ ਇਹ ਵੀ ਬਾਸਮਤੀ ਵੀ ਵਧੀਆ ਹੋ ਜਾਂਦੇ ਹੈਗੇ ਪਰ ਐਂਏ ਆ ਤੁਸੀਂ ਹੁਣ ਪਹਿਲੀ ਵਾਰ ਲਾਉਣਾ ਬਾਹਲੀਆਂ ਵਰਾਈਟੀਆਂ ਜ਼ਿਆਦਾ ਨਾ ਬੀਜੀ ਮੰਨ ਕੇ ਚੱਲ ਤੂੰ ਮੱਕੀ ਆਲੇ 'ਚ ਤੂੰ ਇੱਕ ਸੌ ਛੱਬੀ ਲਾ ਦੀ ਅਤੇ ਬਾਕੀ ਤੂੰ ਦੋ ਸੌ ਬਾਰਾਂ ਲਾ ਲਾ ਹਾਂ ਠੀਕ ਹੈ ਬਾਈ ਹੋਰ ਸਾਰੇ ਠੀਕ ਠਾਕ ਠੀ ਠੀਕ ਆ ਬਾਈ ਠੀਕ ਆ